ਮੈਂ ਆਪਣੀ ਲਾਈਫ਼ ਵਿੱਚ ਪਹਿਲੀ ਵਾਰ ਖਾਣਾ ਬਣਾਉਣਾ ਸ਼ੁਰੂ ਕੀਤਾ ਜਦੋਂ ਮੈਂ ਕੋਲਜ ਵਿੱਚ ਪਿਆ ਐਕਚਲੀ ਮੇਰਾ ਕੋਲਜ ਨਾ ਆਪਣੇ ਸ਼ਹਿਰ ਤੋਂ ਕਾਫ਼ੀ ਦੂਰ ਸੀਗਾ ਅਤੇ ਮੈਂ ਉੱਥੇ ਕੀ ਕੀਤਾ ਹੋਸਟਲ ਲਿੱਤਾ ਸੀਗਾ ਪੀ ਜੀ ਲਿਆ ਸੀ ਰਹਿਣ ਵਾਸਤੇ ਤਾਂ ਉੱਥੇ ਟਿਫ਼ਨ ਲਗਵਾਇਆ ਪਹਿਲਾਂ ਤਾਂ ਟਿਫ਼ਨ ਦਾ ਖਾਣਾ ਵਧੀਆ ਨਹੀਂ ਸੀਗਾ ਅਤੇ ਫੇਰ ਘਰਦਿਆਂ ਨੇ ਕਿਹਾ ਪੁੱਤ ਤੂੰ ਆਪ ਬਣਾਉਣਾ ਸ਼ੁਰੂ ਕਰ ਲਾ ਅਤੇ ਫੇਰ ਜਦੋਂ ਮੈਂ ਆਪ ਬਣਾਉਣਾ ਸ਼ੁਰੂ ਕੀਤਾ ਤਾਂ ਮੈਨੂੰ ਥੋੜ੍ਹਾ ਅਜਿਹਾ ਅਜੀਬ ਲੱਗਾ ਪਹਿਲਾਂ ਯੂਟਿਊਬ ਤੋਂ ਸਿੱਖ ਸਿੱਖ ਕੇ ਕਿਸੇ ਤਰ੍ਹਾਂ ਕਰਨਾ ਪਿਆ ਫਿਰ ਕੀ ਫਿਰ ਇੱਧਰੋ ਉੱਧਰੋਂ ਪੁੱਛ ਕੇ ਕਦੀ ਮੰਮੀ ਨੂੰ ਪੁੱਛ ਲਿਆ ਕਦੀ ਭੈਣ ਨੂੰ ਕਦੀ ਦੋਸਤਾਂ ਨੂੰ ਅਤੇ ਇਸ ਤਰ੍ਹਾਂ ਪੁੱਛ ਕੇ ਕਰਨਾ ਪਿਆ ਪਹਿਲਾਂ ਪਹਿਲਾਂ ਸ਼ੁਰੂ ਸ਼ੁਰੂ 'ਚ ਤਾਂ ਕਿਸੇ ਕੰਮ ਦਾ ਬਣਾਇਆ ਨਹੀਂ ਮਤਲਬ ਖੁ਼ਦ ਨੂੰ ਨਾ ਟੇਸਟ ਆਵੇ ਬਣਾ ਕੇ ਬਣਾਉਣ ਤੋਂ ਬਾਅਦ ਕੀ ਪਤਾ ਹੀ ਨਾ ਲੱਗੇ ਲੂ ਕਦੀ ਲੂਣ ਜ਼ਿਆਦਾ ਹੋ ਜੇ ਕਦੀ ਮਿਰਚ ਜ਼ਿਆਦਾ ਅਤੇ ਕਦੀ ਸੜ ਹੀ ਜਾਵੇ ਸਬਜ਼ੀ ਅਤੇ ਰੋਟੀਆਂ ਤਾਂ ਵੇਲਣੀਆਂ ਹੀ ਨਾ ਆਉਣ ਉਹ ਫੇਰ ਕਿਸੇ ਤਰ੍ਹਾਂ ਕਰਨਾ ਪਿਆ ਪਰ ਇਹ ਤਜ਼ਰਬਾ ਕਾਫ਼ੀ ਵਧੀਆ ਰਿਹਾ ਜੇਕਰ ਆਪਾਂ ਮਤਲਬ ਉਹ 'ਚ ਮੈਂ ਰੁਚੀ ਲਾਈ ਸਿੱਖਣ ਦੀ ਅਤੇ ਮੈਂ ਸਿੱਖਦਾ ਸਿੱਖਦਾ ਸਿੱਖਦਾ ਸਿੱਖਦਾ ਹੁਣ ਵਧੀਆ ਤਰ੍ਹਾਂ ਬਣਾ ਲੈਂਦਾ ਲੋਕਾਂ ਵਾਸਤੇ ਵੀ ਅਤੇ ਆਪਣੇ ਵਾਸਤੇ ਵੀ ਮੇਰੇ ਦੋਸਤ ਵੀ ਹੁਣ ਮੇਰੇ ਹੱਥ ਦੀ ਖਾਂਦੇ ਨੇ ਰੋਟੀਆਂ ਠੀਕ ਆ ਨਾ ਅਤੇ ਮੈਨੂੰ ਵਧੀਆ ਲੱਗਦਾ ਹੈ ਕਿ ਚਲੋ ਮੈਂ ਕੁਕਿੰਗ ਆਪਣੀ ਲਾਈਫ਼ ਵਿੱਚ ਸਿੱਖ ਲਈ ਆ ਅਤੇ ਹੁਣ ਮੈਂ ਇਹੀ ਚਾਹੁੰਦਾ ਹਾਂ ਕਿ ਜੇਕਰ ਲਾਈਫ਼ ਵਿੱਚ ਕਿਸੇ ਨੂੰ ਕਿਤੇ ਰਹਿਣ ਦੀ ਲੋੜ ਪੈ ਜੇ ਬਾਹਰ ਤਾਂ ਆਪਾਂ ਜੇ ਸਾਨੂੰ ਇੰਨਾ ਕੁ ਆਉਂਦਾ ਹੋਏਗਾ ਨਾ ਤਾਂ ਆਪਾਂ ਅਰਾਮ ਨਾਲ ਰਹਿ ਸਕਦੇ ਹਾਂ